ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਬਸ ਤੁਸੀਂ ਸੁਣਾਓ ਹਾਂਜੀ ਵਧੀਆ ਮੈਂ ਉਹੀ ਗੱਲ ਕਰਨੀ ਸੀ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਣੀ ਸੀ ਜਲੰਧਰ ਦੇ ਵਧੀਆ ਤੋਂ ਵਧੀਆ ਸਕੂਲ ਵਿੱਚ ਤੁਸੀਂ ਵੀ ਮੈਨੂੰ ਲੱਗਦਾ ਇਹੀ ਕਰਵਾਉਣਾ ਚਾਹੁੰਦੇ ਹੋ ਆਪਣੇ ਬੱਚੇ ਵਾਸਤੇ ਹਾਂਜੀ ਤੁਸੀਂ ਕਿਹੜੇ ਸਕੂਲ ਬਾਰੇ ਸੋਚਿਆ ਅੱਛਾ ਜੀ ਮੈਂ ਮੇਰੀ ਸਹੇਲੀ ਮੇਰੀ ਸਹੇਲੀ ਨਾਲ ਮੇਰੀ ਇੱਕ ਗੱਲਬਾਤ ਹੋਈ ਸੀ ਉਹਦਾ ਬੱਚਾ ਵੀ ਪੜਦਾ ਏ ਸਕੂਲ ਵਿੱਚ ਉਹਦਾ ਨਾਂ ਏਪੀਜੇ ਹੈ ਤੇ ਉਹ ਕਹਿੰਦੇ ਕਿ ਬੜਾ ਵਧੀਆ ਸਕੂਲ ਹੈ ਬੜੀ ਵਧੀਆ ਉਹਨੀ ਉਹ ਐ ਸਹੂਲਤਾਂ ਦਿੰਦੇ ਹਨ ਹਾਂਜੀ ਹਾਂਜੀ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਸੀ ਕੀ ਜਿਵੇਂ ਏਪੀਜੇ ਚ ਵੀ ਬੜੀ ਵਧੀਆ ਕਲਾਸਾਂ ਨੇ ਬੜੇ ਵਧੀਆ ਉਹਨਾਂ ਨੇ ਮਾਹੌਲ ਬਣਾਏ ਆ ਏਸੀ ਲੱਗੇ ਹੋਏ ਨੇ ਸਹੂਲਤਾਂ ਬਹੁਤ ਵਧੀਆ ਦਿੰਦੇ ਬੱਚਿਆਂ ਨੂੰ ਸਾਫ ਪੀਣ ਦਾ ਪਾਣੀ ਵੀ ਦਿੰਦੇ ਹਨ ਉੱਥੇ ਵੀ ਬੜੀਆਂ ਖੇਡਾਂ ਹੁੰਦੀਆਂ ਨੇ ਜਲੰਧਰ ਦੇ ਜਿਹੜੇ ਟੋਪਰ ਨੇ ਉਹ ਵੀ ਉਸ ਸਕੂਲ ਤੋਂ ਪਰੇ ਹੰਦੇ ਹਨ ਹਾਂਜੀ ਬਹੁਤ ਵਧੀਆ ਹਾਂਜੀ ਮੈਂ ਵੀ ਹੁੰਦੀ ਬੜੀ ਗੱਲਬਾਤ ਸੁਣੀ ਹ ਕਿ ਉਹ ਵਧੀਆ ਉਦਾ ਟੀਚਰ ਦਾ ਸਟਾਫ ਬਹੁਤ ਵਧੀਆ ਉਹ ਵਧੀਆ ਪੜਾਉਂਦੇ ਹਨ ਉਹਨਾਂ ਦੇ ਬੱਚਿਆਂ ਦਾ ਜਿਹੜਾ ਬੇਸ ਹ ਉਹ ਬੜਾ ਵਧੀਆ ਹਾਂਜੀ ਐਮ ਸੀ ਐ ਵੀ ਵਧੀਆ ਸਕੂਲ ਹੈਗਾ ਉਹਨੂੰ ਵੀ ਅਸੀਂ ਵੇਖ ਸਕਦੇ ਆਂ

ਹਾਂਜੀ ਜੀ ਸਵੇਰੇ ਮਿਲਦੇ ਆ ਧੰਨਵਾਦ ਜੀ